ਸਤਿ ਸ਼੍ਰੀ ਅਕਾਲ ਮੈਂ ਸਕੂਲ ਵਿੱਚ ਭਾਰਤੀ ਵਿਗਿਆਨੀਆਂ ਬਾਰੇ ਬਹੁਤ ਕੁਝ ਸਿੱਖਿਆ ਹੈ ਜਿਸ ਵਿੱਚ ਹੈਗੇ ਆ ਸੀ ਵੀ ਰਮਨ ਪੂਰਾ ਨਾਮ ਚੰਦਰਸ਼ੇਖਰ ਵੈਂਕਟ ਰਮਨ ਨੋਵਲ ਪੁਰਸਕਾਰ ਜੇਤੂ ਸੀ ਵੀ ਰਮਨ ਦੇ ਪ੍ਰਕਾਸ਼ ਦੇ ਰਾ ਰਾਵਣ ਪ੍ਰਭਾਵ ਦੀ ਖੋਜ ਕੀਤੀ ਜੋ ਪ੍ਰਕਾਸ਼ ਦੇ ਫੈਲਾਓ ਵਿੱਚ ਬਦਲਾਅ ਨਾਲ ਸੰਬੰਧਿਤ ਹੈ ਦੂਸਰਾ ਜਗਦੀਸ਼ ਚੰਦਰ ਬੋਸ ਉਹਨਾਂ ਨੇ ਰੇਡੀਓ ਅਤੇ ਮਾਈਕਰੋਵੇਵ ਆ ਓਪਿਟਕਸ ਦੇ ਖੇਤਰ ਵਿੱਚ ਯੋਗਦਾਨ ਦਿੱਤਾ ਅਤੇ ਜੀਵ ਵਿਗਿਆਨੀਆਂ ਦੇ ਖੇਤਰ ਵਿੱਚ ਵੀ ਕੰਮ ਕੀਤਾ ਜਿਸ ਵਿੱਚ ਪੌਦਿਆਂ ਦੇ ਜੀਵਨ ਵਿੱਚ ਸੰਗੀਤ ਦੇ ਪ੍ਰਭਾਵ ਨੂੰ ਲੈ ਕੇ ਖੋਜ ਸ਼ਾਮਿਲ ਹੈ ਤੀਸਰਾ ਹੋਮੀ ਜੇ ਭਾਬਾ ਪਰਮਾਣੂ ਵਿਗਿਆਨੀਆਂ ਦੇ ਖੇਤਰ ਵਿੱਚ ਉਹਨਾਂ ਦਾ ਯੋਗਦਾਨ ਮਹੱਤਵਪੂਰਨ ਹੈ ਉਹਨਾਂ ਨੇ ਭਾਰਤੀ ਪਰਮਾਣੂ ਊਰਜਾ ਕਮਿਸ਼ਨ ਦੀ ਸਥਾਪਨਾ ਕੀਤੀ ਅਤੇ ਭਾਰਤ ਦੇ ਪਰਮਾਣੂ ਕਾਰਜਕ੍ਰਮ ਦੇ ਜਨਕ ਮੰਨੇ ਜਾਂਦੇ ਹਨ ਚੌਥਾ ਵਿਕਟ ਰਮਨ ਰਾਮਾ ਕ੍ਰਿਸ਼ਨ ਦੋ ਹਜਾਰ ਨੌਂ ਵਿੱਚ ਰਸਾਇਣ ਵਿਗਿਆਨੀ ਵਿਗਿਆਨ ਵਿੱਚ ਨੋਵਲ ਪੁਰਸਕਾਰ ਜੇਤੂ ਉਹਨਾਂ ਦੇ ਰਿਵਰਸ ਸੁਮਨ ਦੇ

ਮੈਂ ਮਸ਼ਹੂਰ ਭਾਰਤੀ ਵਿਗਿਆਨੀਆਂ ਤੇ ਭਾਰਤੀ ਗਣਿਤ ਸੰਸਕਾ ਸੰਸ ਸ਼ਾਸ਼ਤੀਆਂ ਬਾਰੇ ਵੀ ਬਹੁਤ ਕੁਝ ਸਿੱਖਿਆ ਹੈ ਜਿੱਦਾਂ ਪਹਿਲਾਂ ਸੀ ਸ੍ਰੀ ਨਿਵਾਸ ਰਾਮਾਨੁਜ ਇਹ ਭਾਰਤ ਇਹ ਮਹਾਨ ਭਾਰਤੀ ਗਣਿਤਵ ਜਿਨ੍ਹਾਂ ਨੇ ਗਣਿਤ ਦੇ ਕਈ ਖੇਤਰਾਂ ਵਿੱਚ ਜਿਵੇਂ ਕੀ ਸੰਖਿਆ ਸਿਧਾਂਤ ਸੰਖਿਆ ਸ਼੍ਰੇਣੀਆਂ ਅਤੇ ਅਨ ਅਨੰਤ ਸ਼੍ਰੇਣੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਦੂਸਰਾ ਆਰਿਆ ਭੱਟ ਪੰਜਵੀਂ ਸਦੀ ਦੇ ਇੱਕ ਮਹਾਨ ਗਣਿਤ ਜਵ ਅਤੇ ਭੂਗੋਲ ਸ਼ਾਸ਼ਤਰੀ ਜਿਨਾਂ ਨੇ ਭਾਈ ਦੀ ਕੀਮਤ ਗ੍ਰਹਿਆਂ ਦੀ ਗ ਗਤੀ ਅਤੇ ਸੂਰਜ ਗ੍ਰਹਿਣ ਦੇ ਸਿਧਾਂਤ ਨੂੰ ਸਮਝਿਆ ਬ੍ਰਹਮ ਗੁਪਤ ਸਤਵੀਂ ਸਦੀ ਦੇ ਇੱਕ ਹੋਰ ਪ੍ਰਸਿੱਧ ਗਣਿਤਕਾਰ ਜਿਨ੍ਹਾਂ ਨੇ ਸੁਣੇ ਜ਼ੀਰੋ ਅਤੇ ਤਾਤਮਿਕ ਸੰਖਿਆਵਾਂ ਦੇ ਸਿਧਾਂਤ ਨੂੰ ਵਿਕਸਿਤ ਕੀਤਾ ਧੰਨਵਾਦ ਜੀ